ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਐਪਣੇ ਕੋਲ ਹੈਗੀ ਆ ਸ ਸਵਿਮਿੰਗ ਹੈਗੀ ਹੈ ਜੀ ਆਪਣੇ ਕੋਲ ਜਿੰਮਨਾਸਟਿਕ ਹੈਗੀ ਹੈ ਡਾਂਸ ਹੈਗਾ ਇੱਥੇ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਜਦੋਂ ਹਾਂਜੀ ਬਾਕੀ ਤੁਸੀਂ ਜਦੋਂ ਆਪਣੇ ਆਓਂਗੇ ਕਲੱਬ ਆਓਂਗੇ ਤੁਹਾਨੂੰ ਬਾਕੀ ਪੂਰੀ ਗੱਲਬਾਤ ਉਦੋਂ ਦੱਸ ਦਿਆਂਗੇ

ਹਾਂਜੀ ਹਾਂਜੀ ਉਹ ਉਹ ਤੁਹਾਡੇ 'ਤੇ ਡਿਪੈਂਡ ਹੈ ਜੇ ਜੇਕਰ ਤੁਸੀਂ ਕਰਨਾ ਚਾਹੋ ਤਾਂ ਜਿਵੇਂ ਤੁਹਾਡੇ ਲਈ ਵੀ ਹੈ ਜਿਵੇਂ ਡਾਂਸ ਵਗੈਰਾ ਹੈਗਾ ਜਿਵੇਂ ਜੇਕਰ ਤੁਸੀਂ ਚਾਹੋ ਤਾਂ ਹਾਂਜੀ ਹਾਂਜੀ ਕੰਪੀਟੀਸ਼ਨ ਅਸੀਂ ਬਕਾਇਦਾ ਇਹਦੇ ਲਈ ਸਰਟੀਫਿਕੇਟ ਦਿੰਦੇ ਹਾਂ ਤਾਂ ਕਿ ਬੱਚਿਆਂ ਨੂੰ ਹੋਰ ਵਧੀਆ ਉਪੋਰਚੂਨਿਟੀ ਮਿਲੇ ਇਸ ਤੋਂ ਅੱਗੇ ਜਾਵੇ ਬੱਚਾ ਹਾਂਜੀ ਹਾਂਜੀ ਫੀਸ ਸਟਕਚਰ ਹਾਂਜੀ ਹਾਂਜੀ ਜੇਕਰ ਤੁਸੀਂ ਮਤਲਬ ਹਾਂਜੀ ਹਾਂਜੀ ਜੇਕਰ ਤੁਸੀਂ ਜ਼ਿਆਦਾ ਆਉਂਦੇ ਹੋ ਜ਼ਿਆਦਾ ਕੈਂਡੀਡੇਟ ਹੋ ਤਾਂ ਉਸ ਹਿਸਾਬ ਨਾਲ ਤੁਹਾਡਾ ਫੀਸ ਲੈਕਸ ਲੈਕਸੇਸ਼ਨ ਦਿੱਤੀ ਜਾਊਗੀ ਤੁਹਾਨੂੰ ਉਹਦੀ ਤੁਸੀਂ ਟੈਂਸ਼ਨ ਨਾ ਲਓ ਕੋਈ ਗੱਲ ਨਹੀਂ ਜਦੋਂ ਤੁਸੀਂ ਆਓਂਗੇ ਤਾਂ ਆਪਾਂ ਫੀਸ ਦੇ ਰਿਗਾਰਡਿੰਗ ਉਸ ਟਾਈਮ ਗੱਲ ਕਰ ਲਾਂਗੇ ਹਾਂਜੀ ਹਾਂਜੀ ਸਕੂਲ ਟਾਈਮਿੰਗ ਤੋਂ ਬਾਅਦ ਜੇਕਰ ਅਡਜੈਸਟਮੈਂਟ ਕਰਨੀ ਹੈ ਤਾਂ ਤੁਸੀਂ ਸ਼ਾਮੀ ਭੇਜ ਸਕਦੇ ਹੋ ਕੋਈ ਗੱਲ ਨਹੀਂ ਆਪਣਾ ਕਦੋਂ ਤੱਕ ਬੱਚੇ ਸਕੂਲੋਂ ਆ ਜਾਂਦੇ ਆ ਅੱਛਾ ਅੱਛਾ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਭੇਜ ਸਕਦੇ ਹੋ ਉਹਨਾਂ ਨੂੰ ਬੱਚੇ ਘੰਟੇ ਤੱਕ ਤਾਂ ਘੰਟੇ ਤਾਂ ਫਰੀ ਹੋ ਹੀ ਜਾਂਦੇ ਹੋਣੇ ਹਾਂਜੀ ਹਾਂਜੀ ਨਹੀਂ ਉਹ ਦੀ ਤਾਂ ਗੱਲ ਹੈਗੀ ਆ ਚਲੋ ਕੋਈ ਗੱਲ ਨਹੀਂ ਬਾਕੀ ਤੁਸੀਂ ਪੰਜ ਵਜੇ ਤੋਂ ਸੱਤ ਕੁ ਵਜੇ ਤੱਕ ਦਾ ਟਾਈਮ ਰੱਖ ਲਿਓ ਹਾਂਜੀ ਹਾਂਜੀ ਉਸ ਦੇ ਟਾਈਮ ਦੇ ਵਿੱਚ ਆ ਸਕਦੇ ਹੋ ਤੁਸੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਾਂਜੀ ਉਹ ਜਦੋਂ ਤੁਸੀ ਜਦੋਂ ਤੁਸੀਂ ਆਓਂਗੇ ਨਾ ਆਪਣੇ ਕੋਲ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਹੀ ਕੋਈ ਗੱਲ ਨਹੀਂ ਜਿਵੇਂ ਜੇਕਰ ਤੁਹਾਡੇ ਕੋਲ ਕੈਂਡੀਡੇਟ ਕੈਂਡੀਡੇਟ ਜ਼ਿਆਦਾ ਹੈਗੇ ਆ ਤਾਂ ਉਸ ਵਿੱਚ ਆਪਾਂ ਤੁਹਾਨੂੰ ਰਿਲੈਕਸੇਸ਼ਨ ਦੇਵਾਂਗੇ ਹਾਂਜੀ ਨੈਸ਼ ਨੈਸ਼ਨਲ ਲੈਵਲ ਦਾ ਜੀ ਨੈਸ਼ਨਲ ਲੈਵਲ ਦਾ ਜਿੱਥੇ ਵੀ ਮਤਲਬ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਉਹ ਆਪਣਾ ਫੁੱਲ ਵੈਲਿਡ ਆ ਜੀ ਫੁੱਲ ਵੈਲਿਡ ਆ ਜਿੱਥੇ ਮਰਜੀ ਜਾ ਕੇ ਤੁਸੀਂ ਪੁੱਛ ਲਿਓ ਵੀ ਜਿੱਥੇ ਜਾ ਕੇ ਮਰਜੀ ਅਪਲਾਈ ਕਰ ਸਕਦੇ ਹੋ ਕੁ ਕੁਛ ਵੀ ਹਾਂਜੀ ਹਾਂਜੀ ਤੁਸੀਂ ਮੋਰਨਿੰਗ ਟਾਈਮ ਆ ਜਾਇਓ ਕਦੋਂ ਵੀ ਆ ਸਕਦੇ ਹੋ ਕੋਈ ਦਿੱਕਤ ਨਹੀਂ ਮੋਰਨਿੰਗ ਦਸ ਦਸ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਦਸ ਵਜੇ ਦੀ ਹੀ ਟਾਈਮ ਦੇ ਰਿਹਾ ਦਸ ਕੁ ਵਜੇ ਤੱਕ ਤੁਸੀਂ ਆ ਜਾਇਓ ਕੋਈ ਗੱਲ ਨਹੀਂ ਹਾ ਹਾਂਜੀ ਹਾਂਜੀ ਠੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ ਸਰ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ